ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਜਿਸ ਨੂੰ ਅਸੀਂ ਬੜੇ ਹੀ ਅੱਛੇ ਢੰਗ ਨਾਲ ਬੋਲਦੇ ਹਾਂ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ ਤਾਂ ਕੁਛ ਲੋਕਾਂ ਦੀਆਂ ਗਲਤ ਧਾਰਨਾਵਾਂ ਹਨ ਜੋ ਸਾਡੇ ਪੰਜਾਬੀ ਨੂੰ ਗਲਤ ਸਮਝਦੇ ਹਨ ਪੰਜਾਬੀ ਬੋਲਣਾ ਕੋਈ ਇੱਕ ਬੁਰੀ ਗੱਲ ਨਹੀਂ ਹੈ ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਦੇਖੋ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ ਜੋ ਹਰ ਇੱਕ ਨੂੰ ਸਮਝ ਆ ਜਾਂਦੀ ਹੈ ਪੰਜਾਬ ਜਿਹੜੇ ਲੋਕ ਬਾਹਰੋਂ ਆਉਂਦੇ ਹਨ ਉਹ ਸੋਚਦੇ ਹਨ ਕਿ ਜਿਹੜੇ ਲੋਕ ਪੰਜਾਬੀ ਬੋਲਦੇ ਹਨ ਉਹ ਬਿਲਕੁਲ ਹੀ ਅਨਪੜ੍ਹ ਹਨ ਇਹ ਉਹਨਾਂ ਦੀ ਧਾਰਨਾ ਬਹੁਤ ਹੀ ਗਲਤ ਹੈ ਦੇਖੋ ਅਸੀਂ ਪੰਜਾਬੀ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਅਸੀਂ ਪੰਜਾਬੀ ਹੀ ਬੋਲਣੀ ਹੈ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ ਤਾਂ ਸਾਨੂੰ ਆਪਣਾ ਆਪਣੀ ਮਾਤਰ ਭਾਸ਼ਾ ਦੀ ਯਾਦ ਆਉਂਦੀ ਹੈ ਜਦੋਂ ਅਸੀਂ ਕੁਛ ਗੱਲ ਕਰੀਏ ਕਿ ਅੱਜ ਕੱਲ੍ਹ ਕੁਛ ਇੱਦਾਂ ਦੇ ਸਕੂਲ ਵੀ ਹਨ ਜਿੰਨ੍ਹਾਂ ਵਿੱਚ ਵੀ ਪੰਜਾਬੀ ਬਿਲਕੁਲ ਵੀ ਨਹੀਂ ਪੜ੍ਹਾਈ ਜਾਂਦੀ ਮੇਰੀ ਤੁਹਾਨੂੰ ਇਹੋ ਹੀ ਗੁਜ਼ਾਰਿਸ਼ ਹੈ ਕਿ ਹਰ ਇੱਕ ਸਕੂਲ ਵਿੱਚ ਪੰਜਾਬੀ ਪੜ੍ਹਾਈ ਜਾਵੇ ਪੰਜਾਬੀ ਤਾਂ ਹੀ ਪੜ੍ਹਾਈ ਜਾਵੇਗੀ ਕਿ ਜੇਕਰ ਪੰਜਾਬੀ ਦਾ ਉੱਥੇ ਚੰਗਾ ਅਧਿਆਪਕ ਲੱਗੇਗਾ ਜਦੋਂ ਪੰਜਾਬੀ ਦਾ ਅਧਿਆਪਕ ਲੱਗੇਗਾ ਤਾਂ ਉਹ ਪੰਜਾਬੀ ਪੜ੍ਹਾਵੇਗਾ ਅਤੇ ਬੱਚਿਆਂ ਨੂੰ ਪੰਜਾਬੀ ਆਵੇਗੀ ਪੰਜਾਬੀ ਪੜ੍ਹਨਾ ਕੋਈ ਬੁਰੀ ਗੱਲ ਨਹੀਂ ਹੈ ਪੰਜਾਬੀ ਪੜ੍ਹਨ ਲਈ ਸਾਨੂੰ ਬਹੁਤ ਹੀ ਇੱਕ ਅੱਛੇ ਕਦਮ ਚੁੱਕਣੇ ਚਾਹੀਦੇ ਹਨ ਜਿਹੜੇ ਪੰਜਾਬੀ ਬੋਲਣ ਵਾਲਿਆਂ ਨੂੰ ਗਲਤ ਸਮਝਦੇ ਹਨ ਕਿ ਇਹ ਅਨਪੜ੍ਹ ਹਨ ਉਹਨਾਂ ਦੀ ਧਾਰਨਾ ਬਹੁਤ ਹੀ ਗਲਤ ਹੈ ਦੇਖੋ ਪੰਜਾਬੀ ਇੱਕ ਸਾਡੀ ਮਾਤਰ ਭਾਸ਼ਾ ਹੈ ਅਸੀਂ ਵੀ ਇਸਨੂੰ ਬੜੇ ਹੀ ਅੱਛੇ ਢੰਗ ਨਾਲ ਬੋਲਦੇ ਹਾਂ